ਪੰਜਾਬੀ ਭਾਸ਼ਾ ਸਾਡੀ ਭਾਰਤੀਆਂ ਦੀ ਇੱਕ ਮਾਂ ਬੋਲੀ ਹੈ ਜੋ ਕਿ ਸਾਨੂੰ ਬਹੁਤ ਹੀ ਅੱਗੇ ਲੈ ਕੇ ਜਾਣੀ ਚਾਹੀਦੀ ਹੈ ਪੰਜਾਬੀ ਭਾਸ਼ਾ ਆਪਸ 'ਚ ਹੀ ਇੱਕ ਭਾਸ਼ਾ ਆ ਜਿਹੜੇ ਵਸਨੀਕ ਭਾਰਤ ਵਿੱਚ ਰਹਿੰਦੇ ਹਨ ਉਹ ਪੰਜਾਬੀ ਭਾਸ਼ਾ ਹੀ ਬੋਲਣਗੇ ਤੁਸੀਂ ਵੀ ਦੇਖਿਆ ਹੋਊਗਾ ਜਿਹੜੇ ਬਾਹਰ ਤੋਂ ਲੋਕ ਆਉਂਦੇ ਆ ਉਹ ਪੰਜਾਬੀ ਬੋਲਣ 'ਚ ਬਹੁਤ ਹੀ ਡਿਫੀਕਲਟ ਹੁੰਦੇ ਹਨ ਉਹਨਾਂ ਨੂੰ ਬਹੁਤ ਹੀ ਅਜੀਬ ਲੱਗਦਾ ਏ ਅਤੇ ਜਿਹੜੇ ਸਾਡੇ ਪੰਜਾਬੀ ਹੁੰਦੇ ਹਨ ਉਹਨਾਂ ਨੂੰ ਬੜਾ ਸਮਝਣ 'ਚ ਬੜਾ ਉਹ ਹੁੰਦਾ ਆ ਸਾਨੂੰ ਵੀ ਪਤਾ ਸੰਸਕ੍ਰਿਤ ਅੰਗਰੇਜ਼ੀ ਆਪਣੀ ਜਗ੍ਹਾ ਹਨ ਉਹਨਾਂ ਦੀ ਆਪਣਾ ਪਲੇਸ ਆ ਬਟ ਜੇ ਅਸੀਂ ਭਾਰਤ ਵਿੱਚ ਰਹਿਣਾ ਆ ਤਾਂ ਸਾਨੂੰ ਪੰਜਾਬੀ ਭਾਸ਼ਾ ਸਿੱਖਣੀ ਆ ਕਿ ਤੁਸੀਂ ਵੀ ਦੇਖਿਆ ਹੋਊਗਾ ਜਿਹੜੇ ਸਿੱਧੂ ਮੂਸੇਵਾਲੇ ਸਿੰਗਰ ਆ ਇੰਡਸਟਰੀ ਵਿੱਚ ਉਹ ਵੀ ਆਪਣੀ ਭਾਸ਼ਾ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਨੇ ਦੂਰ ਦੂਰ ਤੱਕ ਇਹ ਚੀਜ਼ਾਂ ਫਲਾਈਆਂ ਈਵਨ ਕਿ ਲੰਡਨ ਤੋਂ ਵੀ ਦੁਨੀਆ ਅਤੇ ਬੰਬੇ ਤੋਂ ਵੀ ਦੁਨੀਆ ਉਹਨੂੰ ਮਿਲਣ ਆਈ ਆ ਉਹਦੇ ਹਰ ਇੱਕ ਚੀਜ਼ ਕਰਨ ਆਈ ਆ ਅਤੇ ਉਹਨੂੰ ਇੰਨਾਂ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ ਪੰਜਾਬੀ ਭਾਸ਼ਾ ਦੇ ਦੁਆਰਾ ਹਰ ਇੱਕ ਸਿੰਗਰ ਉਹਦਾ ਫੈਨ ਸੀਗਾ ਚਾਹੇ ਕੋਈ ਕਿਤੇ ਦਾ ਵੀ ਆ ਚਾਹੇ ਕੋਈ ਫੋਰਨਰ ਆ ਚਾਹੇ ਕੋਈ ਇੰਡੀਅਨ ਆ ਕੁਛ ਵੀ ਆ ਅਤੇ ਉਹਨੂੰ ਬਹੁਤ ਹੀ ਅੱਗੇ ਲੈ ਕੇ ਗਿਆ ਮੈਨੂੰ ਨਹੀਂ ਲੱਗਦਾ ਸੰਸਕ੍ਰਿਤ ਜਾਂ ਅੰਗਰੇਜ਼ੀ ਦੁਆਰਾ ਪੰਜਾਬੀ ਭਾਸ਼ਾ 'ਤੇ ਕੋਈ ਵੀ ਪ੍ਰਭਾਵ ਪਿਆ ਹੋਊਗਾ ਉਹ ਆਪਣੀ ਜਗ੍ਹਾ ਸਹੀ ਹਨ ਅਤੇ ਅਸੀਂ ਸਾਡੀ ਪੰਜਾਬੀ ਭਾਸ਼ਾ ਆਪਣੀ ਜਗ੍ਹਾ ਸਹੀ ਅਗਰ ਅਸੀਂ ਕਿਤੇ ਟਰੈਵਲ ਕਰਨਾ ਆ ਤਾਂ ਸਾਨੂੰ ਹਰ ਇੱਕ ਭਾਸ਼ਾ ਸਿੱਖਣੀ ਚਾਹੀਦੀ ਆ ਨੋ ਡਾਊਟ ਹਰ ਇੱਕ ਕਿਤੇ ਵੀ ਐਕਸਪਲੋਰ ਕਰਨ ਲਈ ਸਾਨੂੰ ਹਰ ਇੱਕ ਭਾਸ਼ਾ ਦੀ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਹੈ ਬਟ ਮੈਨੂੰ ਮੇਰੀ ਪੰਜਾਬੀ ਭਾਸ਼ਾ ਜਿਹੜੀ ਏ ਉਹ 'ਤੇ ਮਾਣ ਆ ਅਤੇ ਮੈਂ ਆਲਵੇਜ਼ ਹੀ ਰਵਾਂਗੀ